ਹੈਲੋ ਕਿੱਥੋਂ ਬੋਲਦੇ ਜੀ ਅੱਛਾ ਤੁਹਾਡੇ ਕਿਹਦੀ ਡੇਅਰੀ ਇਹ ਡੇਅਰੀ ਕਿਹੜੀ ਕਿਹੜੀ ਡੇਅਰੀ ਹੁੰਦੀ ਆ ਮਿੱਠੀ ਵੀ ਲੱਸੀ ਹੁੰਦੀ ਅੱਛਾ ਤੇ ਪੁਦੀਨੇ ਵਾਲੀ ਵੀ ਹੁੰਦੀ ਏ

ਤੇ ਕਿੰਨੇ ਦੀ ਹੈ ਇੱਕ ਗਲਾਸ ਕਿੰਨੇ ਦਾ ਅੱਛਾ ਉਹ ਕਿਲੋ ਵਾਲੀ ਕਿੰਨੇ ਦੀ ਹੈ ਅੱਛਾ ਅੱਛਾ ਤੇ ਕਿਹੜੇ ਸਾਈਡ ਸ਼ੋਪ ਐ ਅੱਛਾ ਅੱਛਾ ਦੁਕਾਨਦਾਰ ਨਾਮ ਹੈ ਕੋਈ ਡੇਅਰੀ ਦਾ ਅੱਛਾ ਤੇ ਔਰ ਔਰ ਵੀ ਕੁਝ ਹੁੰਦਾ ਕਿ ਦਹੀ ਵੀ ਹੁੰਦੀ ਆ ਅੱਛਾ ਕੁਆ ਕੁਆਲਿਟੀ ਕਿਵੇਂ ਐ ਤੁਹਾਡੀ ਇੱਕ ਦਸ ਰੁਪਏ ਦਾ ਗਿਲਾਸ ਹੈ ਵੀਹ ਦਾ ਹੈ ਅੱਛਾ ਅੱਛਾ ਅੱਛਾ ਡਿੱਬਾ ਕਿਲੋ ਦਾ ਹੁੰਦਾ ਕਿੰਨੇ ਦਾ ਹੁੰਦਾ ਅੱਛਾ ਅੱਛਾ ਅੱਛਾ ਪਾਊਚ ਪਾਊਚ ਹੁੰਦਾ ਹੈ ਚਲੋ ਠੀਕ ਠੀਕ ਠੀਕ